ਮੇਰਾ ਨਾਮ ਜੁਗਰਾਜ ਸਿੰਘ ਹੈ ਅਤੇ ਮੈਂ ਪਿੰਡ ਰੈਲਮਾਜਰੇ ਦਾ ਰਹਿਣ ਵਾਲਾ ਹਾਂ ਸਾਡੇ ਪਿੰਡ ਵਿੱਚ ਕਾਫੀ ਛੋਟੀਆਂ ਵੱਡੀਆਂ ਦੁਕਾਨਾਂ ਹਨ ਅਤੇ ਇੱਕ ਛੋਟਾ ਜਿਹਾ ਬਾਜ਼ਾਰ ਵੀ ਹੈ ਅਤੇ ਸਾਡੇ ਨਾਲ ਲੱਗਦੇ ਸ਼ਹਿਰ ਰੋਪੜ ਵਿੱਚ ਵੀ ਕਾਫੀ ਵੱਡੇ ਛੋਟੇ ਬਾਜ਼ਾਰ ਹਨ ਵੱਡੇ ਛੋਟੇ ਬਿਜ਼ਨਸ ਵੀ ਚਲਦੇ ਹਨ ਜਿੱਥੇ ਉਹਨਾਂ ਦਾ ਅ ਗੁਜ਼ਾਰਾ ਹੁੰਦਾ ਹੈ ਸਾਡੇ ਪਿੰਡ ਦੀ ਗੱਲ ਕਰੀਏ ਤਾਂ ਸਾਡੇ ਇੱਕ ਸਬਜ਼ੀ ਬਾਜ਼ਾਰ ਹੈ ਜਿਸ ਵਿੱਚ ਛੋਟੇ ਕਿਸਾਨ ਆਪਣੀਆਂ ਸਬਜ਼ੀਆਂ ਵੀ ਸਬਜ਼ੀਆਂ ਵੇਚਦੇ ਹਨ ਜਿਸ ਨਾਲ ਉਹਨਾਂ ਦਾ ਬਿਜਨਸ ਚੰਗੀ ਤਰ੍ਹਾਂ ਚੱਲ ਜਾਂਦਾ ਹੈ ਅਤੇ ਘਰ ਬਾਰ ਵੀ ਉਹਨਾਂ ਦਾ ਚੰਗਾ ਖਰਚਾ ਚੱਲ ਜਾਂਦਾ ਹੈ ਅਤੇ ਗੱਲ ਕਰੀਏ ਸ਼ਹਿਰ ਦੀ ਸ਼ਹਿਰ ਵਿੱਚ ਕਾਫੀ ਵੱਡੇ ਬਾਜ਼ਾਰ ਹਨ ਜਿੱਥੋਂ ਕਿ ਆਪਾਂ ਮਹਿੰਗੀਆਂ ਸਸਤੀਆਂ ਕਾਫੀ ਚੀਜ਼ਾਂ ਖਰੀਦ ਸਕਦੇ ਹਾਂ ਅਤੇ ਕੁਆਲਿਟੀ ਦੀਆਂ ਚੀਜ਼ਾਂ ਮਿਲਦੀਆਂ ਹਨ ਉੱਥੇ ਅਤੇ ਜੇ ਗੱਲ ਕਰੀਏ ਸਬਜ਼ੀਆਂ ਦੀ ਕੀਮਤਾਂ ਦੀ ਤਾਂ ਕੀਮਤਾਂ ਪਿਛਲੇ ਸਾਲ ਦੇ ਕੰਪੈਰੀਜ਼ਨ ਹੁਣ ਕਾਫੀ ਕੀਮਤਾਂ ਵੱਧ ਚੁੱਕੀਆਂ ਹਨ ਉਹਦਾ ਰੀਜ਼ਨ ਹੋ ਸਕਦਾ ਮਹਿੰਗਾਈ ਅਤੇ ਮਹਿੰਗਾਈ ਜ ਟਰਾਂਸਪੋਰਟੇਸ਼ਨ ਕੋਸਟ ਵੱਧਣ ਕਰਕੇ ਵੀ ਇਹਨਾਂ ਦੀ ਕੀਮਤਾਂ ਸਬਜ਼ੀ ਦੀਆਂ ਵੱਧੀਆਂ ਹਨ ਅਤੇ ਕਾਫੀ ਸਾਡੇ ਸਾਡੇ ਦੇਸ਼ ਦੀ ਕਰੰਸੀ ਦੀ ਵੈਲਿਊ ਵੱਧਣ ਘਟਨ ਕਰਕੇ ਵੀ ਇਹ ਚੀਜ਼ਾਂ ਦੀ ਕੀਮਤਾਂ ਅਪ ਡਾਊਨ ਹੁੰਦੀ ਰਹਿੰਦੀ ਹੈ ਅਤੇ ਇਸੇ ਕਰਕੇ ਸਬਜ਼ੀਆਂ ਦੀ ਕ ਕੀਮਤਾਂ ਵੱਧੀਆਂ ਹਨ ਅਤੇ ਹੁਣ ਇਹ ਖਰੀਦਦਾਰੀ ਮੈਂ ਕਰਦਾ ਰਹਿਦਾ ਹਾਂ ਅਤੇ ਮਹੀਨੇ ਦੇ ਇੱਕ ਦੋ ਵਾਰ ਕਰਦਾ ਹਾਂ ਔਨਲਾਈਨ ਸ਼ੋਪਿੰਗ ਔਨਲਾਈਨ ਸ਼ੋਪਿੰਗ ਦਾ ਫਾਇਦਾ ਇਹ ਹੈ ਕਿ ਸਾਨੂੰ ਸਸਤੇ ਸਸਤੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਸਸਤੇ ਰੇਟ ਵਿੱਚ ਮਿਲ ਜਾਂਦੀਆਂ ਹਨ ਅਤੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਨੂੰ ਘਰ ਬੈਠੇ ਚੀਜ਼ਾਂ ਉਪਲਬਧ ਹੁੰਦੀਆਂ ਹਨ ਅਤੇ ਮਾੜਾ ਇਸਦਾ ਇਹ ਹੈ ਕਿ ਅਸੀਂ ਕਈ ਵਾਰ ਸਾਨੂੰ ਕੁਆਲਿਟੀ ਵਧੀਆ ਨਹੀਂ ਮਿਲਦੀ ਜੋ ਦਿਖਾਇਆ ਜਾਂਦਾ ਹੈ ਔਨਲਾਈਨ ਐਪਸ 'ਤੇ ਉਹ ਫਿਰ ਜਦੋਂ ਚੀਜ਼ ਡਿਲੀਵਰ ਹੁੰਦੀ ਹੈ ਤਾਂ ਉਸ ਵਿੱਚ ਕੁਆਲਿਟੀ ਕੁਛ ਹੋਰ ਹੀ ਹੁੰਦੀ ਹੈ ਜਾਂ ਕੋਈ ਹੋਰ ਹੀ ਪ੍ਰੋਡਕਟ ਆ ਜਾਂਦਾ ਹੈ ਅਤੇ ਇਸ ਦਾ ਇਹ ਮਾੜਾ ਹੋ ਸਕਦਾ